ਛੇ ਨਵੰਬਰ ਉੱਨੀ ਸੌ ਬਿਆਸੀ ਦੋ ਮਈ ਦੋ ਹਜ਼ਾਰ ਇੱਕੀ ਪੰਦਰਾਂ ਮਾਰਚ ਦੋ ਹਜ਼ਾਰ ਬਾਈ ਛੱਬੀ ਅਪ੍ਰੈਲ ਦੋ ਹਜ਼ਾਰ ਦਸ ਛੱਬੀ ਜਨਵਰੀ ਦੋ ਹਜ਼ਾਰ ਚੌਵੀ